ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਮੈਂ ਪਿੰਡ ਹੁਸੈਨਪੁਰ ਤੋਂ ਅਮਨਦੀਪ ਸਿੰਘ ਗੱਲ ਕਰ ਰਿਹਾ ਮੈਂ ਆਪਣਾ ਦੁਪਹਿਰ ਦਾ ਖਾਣਾ ਓਡਰ ਕੀਤਾ ਸੀਗਾ ਅਤੇ ਹੁਣ ਤੱਕ ਤੁਹਾਡਾ ਖਾਣਾ ਪਹੁੰਚਿਆ ਨਹੀਂ ਸੌ ਖਾਣਾ ਲੇਟ ਹੋ ਗਿਆ ਮੈਂ ਹੁਣ ਆਪਣੀ ਡਿਊਟੀ ਵਾਸਤੇ ਨਿਕਲ ਗਿਆ ਮੈਂ ਆਈ ਆਈ ਟੀ ਰੋਪੜ ਜੋਬ ਕਰਦਾ ਤੁਸੀਂ ਆਈ ਆਈ ਟੀ ਰੋਪੜ ਮੇਨ ਕੈਂਪਸ ਮੈਟਾਲੋਜੀਕਲ ਡਿਪਾਰਟਮੈਂਟ 'ਚ ਮੇਰਾ ਖਾਣਾ ਪਹੁੰਚਾ ਦਿਉ ਦੁਪਹਿਰ ਦਾ